ਮੇਰਾ ਨਾਮ ਕੋਮਲ ਹੈ ਅਤੇ ਮੈਂ ਐਮਾਜੋਨ ਤੋਂ ਕਾਫੀ ਜ਼ਿਆਦਾ ਔਨਲਾਈਨ ਸ਼ੋਪਿੰਗ ਕੀਤੀ ਜਿੱਦਾਂ ਕਿ ਮੈਂ ਉਹ ਤੋਂ ਸਟੇਟਨਰ ਮੰਗਵਾਇਆ ਅਤੇ ਕਈ ਲੋਕ ਬੋਲਦੇ ਆ ਕਿ ਜਦੋਂ ਆਪਾਂ ਔਨਲਾਈਨ ਸ਼ੋਪਿੰਗ ਕਰਦੇ ਹਾਂ ਅਤੇ ਉਹਦੇ ਵਿੱਚ ਜਿਹੜੇ ਪ੍ਰੋਡਕਟਸ ਆਉਂਦੇ ਆ ਉਹ ਇੰਨੇ ਜ਼ਿਆਦਾ ਵਧੀਆ ਨਹੀਂ ਆਉਂਦੇ ਬਟ ਮੈਂ ਉਹਨੂੰ ਮੰਗਵਾਇਆ ਸੀ ਔਨਲਾਈਨ ਐਮਾਜੋਨ ਤੋਂ ਉਹਨੂੰ ਮੈਂ ਮੰਗਵਾਇਆ ਸੀ ਸਟੇਟਨਰ ਨੂੰ ਐਂਡ ਉਹ ਕਾਫੀ ਜ਼ਿਆਦਾ ਵਧੀਆ ਆਇਆ ਸੀਗਾ ਉਹਦਾ ਪ੍ਰਾਈਜ ਵੀ ਮਾਰ ਇੱਕ ਤਾਂ ਉਹਦਾ ਮਾਰਕੀਟ ਦੇ ਪ੍ਰਾਈਜ਼ ਨਾਲੋਂ ਕਾਫੀ ਜ਼ਿਆਦਾ ਘੱਟ ਪ੍ਰਾਈਜ਼ ਸੀਗਾ ਇੱਕ ਉਹ ਵਧੀਆ ਬਹੁਤ ਸੀਗਾ ਕੁਆਲਿਟੀ ਵੀ ਉਹਦੀ ਵਧੀਆ ਸੀਗੀ ਜਿੱਦਾਂ ਜਿੱਦਾਂ ਉਹਨਾਂ ਨੇ ਦੱਸਿਆ ਸੀਗਾ ਉ ਉਹ ਉਸ ਤੋਂ ਵੀ ਜ਼ਿਆਦਾ ਕਾਫੀ ਜ਼ਿਆਦਾ ਬੈਟਰ ਸੀਗਾ ਐਂਡ ਉਹ ਜੋ ਜਿੱਦਾਂ ਜਿੱਦਾਂ ਉਹਨਾਂ ਨੇ ਬੋਲਿਆ ਸੀ ਕਿ ਕਿ ਉਹ ਜਿੱਦਾਂ ਵਰਕ ਕਰੇਗਾ ਉਸਦਾ ਹੀ ਵਰਕ ਕਰ ਰਿਹਾ ਸੀਗਾ ਅਤੇ ਇਸ ਤੋਂ ਇਲਾਵਾ ਮੈਂ ਹੋਰ ਵੀ ਬਹੁਤ ਸਭ ਕੁਛ ਔਨਲਾਈਨ ਮੰਗਵਾਇਆ ਸੀ ਜਿੱਦਾਂ ਆਦੀਬਾਸੀ ਹਰਬਲ ਹੇਅਰ ਮੈਂ ਓਇਲ ਮੰਗਵਾਇਆ ਸੀਗਾ ਐਂਡ ਉਹ ਵੀ ਹੇਈ ਜਿਹੜਾ ਹੇਅਰ ਓਇਲ ਸੀਗਾ ਉਹ ਕਾਫੀ ਜ਼ਿਆਦਾ ਬੈਨੀਫਿਟ ਸੀਗਾ ਉਹਦਾ ਵੀ ਮਾਰਕੀਟ ਦੇ ਅਕੋਰਡਿੰਗ ਅਗਰ ਅਸੀਂ ਜਾਈਏ ਤਾਂ ਉਹਦਾ ਕਾਫੀ ਜ਼ਿਆਦਾ ਪ੍ਰਾਈਜ਼ ਸੀਗਾ ਬਟ ਜਦੋਂ ਉਹਨੂੰ ਮੈਂ ਔਨਲਾਈਨ ਦੇਖਿਆ ਸੀਗਾ ਤਾਂ ਔਨਲਾਈਨ ਵਿੱਚ ਉਹਦਾ ਕਾਫੀ ਘੱਟ ਪ੍ਰਾਈਜ਼ ਸੀਗਾ ਜੋ ਕਿ ਇੱਕ ਬਹੁਤ ਹੀ ਬੈਨੀਫਿਟ ਸੀਗਾ ਹੇਅਰਸ ਦੇ ਲਈ ਜਿਹਦੇ ਲਗਾਉਣ ਦੇ ਨਾਲ ਜਿਹੜੇ ਬੋਲਦੇ ਸੀਗੇ ਕਿ ਜਿਹੜੇ ਹੇਅਰਸ ਆ ਜਿਨ੍ਹਾਂ ਦੇ ਝੜਦੇ ਆ ਉਹ ਉਹ ਵੀ ਰੁਕ ਜਾਂਦੇ ਆ ਬਟ ਉਹਨਾਂ ਦੀ ਗਰੋਥ ਵੀ ਹੁੰਦੀ ਆ ਅਤੇ ਉਹ ਸਾਰੇ ਜਦੋਂ ਮੈਂ ਔਨਲਾਈਨ ਤੋਂ ਮੰਗਵਾਇਆ ਸੀਗਾ ਤਾਂ ਉਹ ਕਾਫੀ ਹੀ ਜ਼ਿਆਦਾ ਬੈਨੀਫਿਟ ਹੇਅਰ ਓਇਲ ਸੀਗਾ